ਹਾਂਜੀ ਅਸੀਂ ਬਾਹਰੋਂ ਆਏ ਹਾਂ ਜੀ ਬਰਨਾਲੇ ਘੁੰਮਣ ਵਾਸਤੇ ਅਤੇ ਇੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖਣ ਯੋਗ ਨੇ ਜੀ ਧਾਰਮਿਕ ਸਥਾਨ ਜਾਂ ਕੋਈ ਮੋਲ ਵਗੈਰਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਆਵਾਂਗੇ ਤੁਹਾਨੂੰ ਪਹਿਲਾਂ ਫੋਨ ਕਰਕੇ ਆਵਾਂਗੇ ਜੀ ਸਾਨੂੰ ਨਾਲ ਲੈ ਚੱਲਿਉ ਤੁਸੀਂ ਹਾਂਜੀ ਪਾਰਕ ਹਾਂ ਪਾਰਕ ਵਗੈਰਾ ਕੋਈ ਫੈਕਟਰੀ ਹਾਂਜੀ ਹਾਂਜੀ

ਹਾਂਜੀ ਅਸੀਂ ਗੁਰੂ ਘਰ ਦੇ ਦਰਸ਼ਨ ਵੀ ਕਰਕੇ ਜਾਵਾਂਗੇ ਜੋ ਤੁਸੀਂ ਪਹਿਲੇ ਵਾਲੀ ਸਰ ਅਤੇ ਹਾਂਜੀ ਹਾਂਜੀ

ਹਾਂਜੀ ਖਾਣ ਪੀਣ ਵਾਸਤੇ ਕੋ ਕੋਈ ਹੋਟਲ ਵਗੈਰਾ

ਹਾਂਜੀ ਫੈਕਟਰੀਆਂ ਵਗੈਰਾ

ਅਸੀਂ ਜਦੋਂ ਆਵਾਂਗੇ ਜੀ ਜ਼ਰੂਰ ਆਵਾਂਗੇ ਸਾਨੂੰ ਸਾਰੀਆਂ ਚੀਜ਼ਾਂ ਦਿਖਾ ਦਿਓ ਜੀ ਜੋ ਵੀ ਧਾਰਮਿਕ ਸਥਾਨ ਇੱਥੇ ਕੋਈ ਆਊਟਲੈਟ ਵਗੈਰਾ ਆਧਾਰ ਜੋ ਕੁਛ ਵੀ ਹੈ ਸਾਨੂੰ ਨਾਲ ਲਿਜਾ ਕੇ ਦਿਖਾ ਦਿਓ

ਓਕੇ